ਪਸੰਦੀਦਾ ਸ਼ੈਲੀਆਂ ਦੇ ਵਿੱਚ ਇੱਕ ਸ਼ੈਲੀ ਇਹ ਵੀ ਹੈ ਕਿ ਮਨੁੱਖੀ ਜੀਵਨ ਔਰ ਮਨੁੱਖੀ ਕਦਰਾਂ ਕੀਮਤਾਂ ਦਾ ਖਿਆਲ ਰੱਖਣਾ ਕਿਉਂਕਿ ਜੇਕਰ ਅਸੀਂ ਮਨੁੱਖੀ ਕਦਰਾਂ ਕੀਮਤਾਂ ਦਾ ਖਿਆਲ ਰੱਖਾਂਗੇ ਤਾਂ ਸਾਡਾ ਜੀਵਨ ਅਤੇ ਸਾਡੇ ਸਮਾਜ ਦਾ ਬਹੁਤ ਵੱਡਾ ਪੱਧਰ ਉੱਚਾ ਹੋਵੇਗਾ ਇਸ ਦੇ ਸ ਪਿਛਲੇ ਸਮੇਂ ਦੇ ਅੰਦਰ ਕਿਤਾਬ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਪੜ੍ਹੀ ਜਿਸ ਦਾ ਮਨੋਰਥ ਹੀ ਇਹ ਸੀ ਕਿ ਜੀਵਨ ਦੇ ਵਿੱਚ ਚਲਦਿਆਂ ਚਲਦਿਆਂ ਜਿੱਥੇ ਅਸੀਂ ਆਪਣਾ ਪਰਿਵਾਰਕ ਜੀਵਨ ਸਮਾਜਿਕ ਜੀਵਨ ਬਿਤਾਉਣਾ ਹੈ ਉੱਥੇ ਅਸੀਂ ਸਮਾਜ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹਾਂ ਅਤੇ ਕਿਵੇਂ ਕਿਸ ਪੱਧਰ 'ਤੇ ਜਾ ਕੇ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਜਾਂ ਸਾਡੀ ਮਦਦ ਦੇ ਨਾਲ ਉਹਨਾਂ ਦੇ ਵਿੱਚ ਕੀ ਵਾਧਾ ਹੋ ਸਕਦਾ ਹੈ ਕੀ ਵਿਕਾਸ ਹੋ ਸਕਦਾ ਹੈ ਇਸ ਪੱਧਰ ਨੂੰ ਉੱਚਾ ਚੁੱਕਿਆ ਜਾਣ ਦੇ ਲਈ